ਅੱਜ ਦੇ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਹਰ ਜਗ੍ਹਾ ਹੋ ਰਹੀ ਹੈ ਇਹ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸਾਂ ਵਿਦੇਸਾਂ ਵਿੱਚ ਵੀ ਬੋਲੀ ਜਾਂਦੀ ਹੈ ਰੇਡੀਓ ਵਿੱਚ ਪੰਜਾਬੀ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਉਂਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਵਿੱਚ ਖਬਰਾਂ ਵੀ ਆਉਂਦੀਆਂ ਹਨ ਅਤੇ ਪੰਜਾਬੀ ਗਾਣੇ ਵੀ ਸੁਣਾਏ ਜਾਂਦੇ ਹਨ ਟੈਲੀਵਿਜ਼ਨ ਵਿੱਚ ਪੰਜਾਬੀ ਫਿਲਮਾਂ ਪੰਜਾਬੀ ਗਾਣੇ ਪੰਜਾਬੀ ਲੋਕ ਗੀਤ ਦੀਆਂ ਵੀਡੀਓਜ਼ ਦਿਖਾਈ ਜਾਂਦੀਆਂ ਹਨ ਪ੍ਰਿੰਟਿੰਗ ਦੀ ਵਰਤੋਂ ਪੰਜਾਬੀ ਵਿੱਚ ਚਿੱਠੀ ਪੱਤਰ ਅਖਬਾਰ ਪ੍ਰਿੰਟ ਕੀਤੇ ਜਾਂਦੇ ਹਨ ਹੁਣ ਤਾਂ ਪੰਜਾਬੀ ਭਾਸ਼ਾ ਵੀ ਹਰ ਵਰਗ ਦੇਸ਼ ਲੋਕ ਸਿੱਖ ਵੀ ਰਹੇ ਨੇ ਅਤੇ ਬੋਲ ਵੀ ਰਹੇ ਨੇ ਸ਼ੋਸ਼ਲ ਮੀਡੀਆ ਉੱਤੇ ਲੋਕਾਂ ਨੇ ਆਪਣੇ ਪੰਜਾਬੀ ਚੈਨਲ ਬਣਾਏ ਹੋਏ ਹਨ ਅੱਜ ਦੇ ਪੱਧਰ ਵਿੱਚ ਪੰਜਾਬੀ ਭਾਸ਼ਾ ਦਾ ਪੱਧਰ ਬਹੁਤ ਉੱਚਾ ਹੋ ਗਿਆ ਹੈ